ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਵਪ੍ਰੀਤ ਸਿੰਘ ਮੈਂ ਸ ਸੈਮਸੰਗ ਕੰਪਨੀ ਤੋਂ ਪ੍ਰੋਡਕਟ ਮੰਗਵਾਇਆ ਸੀ ਅਤੇ ਮੇਰਾ ਉਹਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਮਾੜਾ ਰਿਹਾ ਉਹ ਆਉਂਦੇ ਹੀ ਘਰੇ ਬੰਦ ਹੋ ਗਿਆ ਅਤੇ ਉਹ ਬਿਲਕੁਲ ਨਹੀਂ ਚੱਲਿਆ ਹੈਗਾ ਅਤੇ ਮੈਂ ਕਈ ਵਾਰੀ ਕੰਪਲੇਂਟ ਵੀ ਪਾ ਚੁੱਕਿਆ ਸ਼ਿਕਾਇਤ ਕੀਤੀ ਗਈ ਹੈ ਪਰ ਉਹਦਾ ਸ਼ਿਕਾਇਤ ਦਾ ਕੋਈ ਨਿਵਾਰਨ ਹੋਇਆ ਨਹੀਂ ਅਤੇ ਮੈਂ ਹੁਣ ਉਹ ਪ੍ਰੋਡਕਟ ਤੁਹਾਨੂੰ ਵਾਪਸ ਕਰਨਾ ਚਾਹੁੰਦਾ ਏਂ ਅਤੇ ਆਪਣੇ ਕਿਸੇ ਕੰਪਨੀ ਦੇ ਮੈਂਬਰ ਨੂੰ ਸਾਡੇ ਘਰੇ ਭੇਜਿਆ ਜਾਵੇ ਅਤੇ ਉਹ ਪ੍ਰੋਡਕਟ ਹੈ ਉਹ ਵਾਪਸ ਲ ਲੈ ਕੇ ਜਾਵੇ ਅਤੇ ਮੇਰੇ ਪੈਸੇ ਵਾਪਸ ਕਰੇ ਧੰਨਵਾਦ